ਕੋਵਿਡ ਉੱਨੀ ਵਿੱਚ ਮਹਾਂਮਾਰੀ ਦੌਰਾਨ ਖੇਤਰ ਦੇ ਵਿੱਚ ਬਹੁਤ ਨੁਕਸਾਨ ਹੋਇਆ ਅਤੇ ਭਾਰਤ ਦੇ ਵਿੱਚ ਕਿਉਂਕਿ ਇਹਦੇ ਵਿੱਚ ਕੰਮਾਂ ਕਾਰਾਂ ਹੋਰ ਆਦਿ ਕੁਛ ਦਾ ਬਹੁਤ ਨੁਕਸਾਨ ਹੋਇਆ ਨਾ ਅਸੀਂ ਕਿਤੇ ਬਾਹਰ ਆ ਜਾ ਸਕਦੇ ਸੀ ਅਤੇ ਇਹਦਾ ਕਾਰਨ ਬਹੁਤ ਮੁਸ਼ਕਿਲਾਂ ਆਈਆਂ ਹਨ ਕਿ ਕੰਮਾਂ ਕਾਰਾਂ ਤੋਂ ਖਾਣੇ ਪੀਣੇ ਤੋਂ ਕਾਫੀ ਕੁਛ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਅਸੀਂ ਕਿਸੇ ਨੂੰ ਵੀ ਮਿਲਣ ਵਰਤਣ ਜਾਣਾ ਆ ਤਾਂ ਸਾਨੂੰ ਸੈਨਾਟਾਈਜ਼ ਕਰਨਾ ਪੈਂਦਾ ਸੀ ਅਤੇ ਜਿ ਜਿਸ ਨੂੰ ਬੁਖਾਰ ਜੁਕਾਮ ਖਾਂਸੀ ਆਦਿ ਹੋਇਆ ਸੀ ਉਹ ਤੋਂ ਕਾਫੀ ਫਾਸਲਾ ਬਣਾ ਕੇ ਰੱਖਣਾ ਪੈਂਦਾ ਸੀ ਅਤੇ ਉਹਨੂੰ ਅਲੱਗ ਕਮਰੇ ਵਿੱਚ ਰੱਖਿਆ ਜਾਂਦਾ ਸੀ ਅਤੇ ਆਪਣੇ ਆਪ ਨੂੰ ਬਚਾਉਣਾ ਅਤੇ ਆਪਣੇ ਪਰਿਵਾਰ ਨੂੰ ਬਚਾਉਣਾ ਆਦਿ ਬਹੁਤ ਸਾਨੂੰ ਸੁਰੱਖਿਆ ਰੱਖਣੀ ਪੈਂਦੀ ਸੀ ਇਸ ਕਾਰਨ ਸਾਡੀ ਪੰਜਾਬ ਦੀ ਪੁਲਿਸ ਸਾਡੀ ਉਹਨਾਂ ਨੇ ਬਹੁਤ ਸਹਾਇਤਾ ਕੀਤੀ ਸਾਨੂੰ ਕਿਤੇ ਆਉਣ ਜਾਣ ਨਹੀਂ ਦਿੰਦੇ ਸੀ ਅਤੇ ਸਾਨੂੰ ਜੋ ਵੀ ਰਾਸ਼ਨ ਦੀ ਲੋੜ ਸੀ ਉਹ ਸਾਨੂੰ ਸਾਡੇ ਘਰੇ ਬਚਾਇਆ ਜਾਂਦਾ ਸੀ ਇਸ ਕਾਰਨ ਅਤੇ ਘਰ ਦੇ ਪਰਿਵਾਰ ਦੇ ਵਿੱਚ ਵੀ ਸਾਰੇ ਅਲੱਗ ਅਲੱਗ ਰਹਿੰਦੇ ਸਨ ਕਿਤੇ ਜੇ ਬਾਹਰ ਬਾਈ ਚਾਂਸ ਐਮਰਜੰਸੀ ਜਾਣਾ ਵੀ ਪਵੇ ਸਾਨੂੰ ਡੀ ਸੀ ਦੀ ਪਰਮਿਸ਼ਨ ਲੈਣੀ ਪੈਂਦੀ ਸੀ ਅਤੇ ਵੱਧ ਤੋਂ ਵੱਧ ਬੱਸ ਵਿੱਚ ਪੱਚੀ ਜਾਣੇ ਸਫਰ ਕਰ ਸਕਦੇ ਸਨ ਅਤੇ ਸਾਨੂੰ ਜ਼ਿਆਦਾ ਰਸ਼ ਨਹੀਂ ਪਾਉਣਾ ਪੈਂਦਾ ਸੀ ਕਿਸੇ ਪਾਸੇ ਜਾਂ ਹੋਸਪਿਟਲ ਜਾਂ ਕਿਤੇ ਹੋਰ ਪਾਸੇ ਸਾਨੂੰ ਕਾਫੀ ਫਾਸਲਾ ਬਣਾ ਕੇ ਰੱਖਣਾ ਪੈਂਦਾ ਸੀ ਅਤੇ ਇਹਦੇ ਵਿੱਚ ਅਸੀਂ ਆਪਣੇ ਪਰਿਵਾਰ ਦੀ ਸੁਰੱਖਿਆ ਕਰਦੇ ਹਨ ਕਿਉਂਕਿ ਅਸੀਂ ਪਰਿਵਾਰ ਦੇ ਸਾਰੇ ਜਾਣੇ ਅਲੱਗ ਅਲੱਗ ਰਹਿੰਦੇ ਸੀ ਜੋ ਕਿ ਬਿਮਾਰੀ ਤੋਂ ਦੂਜੇ ਬੰਦੇ ਨੂੰ ਨਾ ਫੈਲੇ ਇਸ ਕਰਕੇ ਅਸੀਂ ਪਰਿਵਾਰ ਦੇ ਵਿੱਚ ਕੁਛ ਵੀ ਕਰਨਾ ਹੈ ਤਾਂ ਦੂਰੀ ਬਣਾ ਕੇ ਕਰਨਾ ਹੈ